ਫੋਟੋਗ੍ਰਾਫੀ ਸਿਰਫ ਤਸਵੀਰਾਂ ਖਿੱਚਣ ਬਾਰੇ ਨਹੀਂ ਹੈ ਬਲਕਿ ਇੱਕ ਤਸਵੀਰ ਨੂੰ ਸ਼ਾਨਦਾਰ ਬਣਾਉਣ ਬਾਰੇ ਵੀ ਹੈ ਅਤੇ ਤਸਵੀਰਾਂ ਨੂੰ ਸੰਪਾਦਿਤ ਕਰਨ ਦੀ ਕਾਫੀ ਲੋੜ ਪੈਂਦੀ ਹੈ ਕਿਉਂਕਿ ਕਦੀ ਕਦਾਰ ਜਦੋਂ ਅਸੀਂ ਕੋਈ ਤਸਵੀਰ ਖਿੱਚਦੇ ਹਾਂ ਉਹ ਫੋਟੋ ਕਾਫੀ ਹਨੇਰੇ ਵਿੱਚ ਹੁੰਦੀ ਹੈ ਜਾਂ ਉਹਦੇ ਵਿੱਚ ਕਾਫੀ ਜ਼ਿਆਦਾ ਚਮਕ ਹੁੰਦੀ ਹੈ ਤਾਂ ਉਸ ਤਸਵੀਰ ਨੂੰ ਸ਼ਾਨਦਾਰ ਬਣਾਉਣ ਲਈ ਸਾਨੂੰ ਉਹਨੂੰ ਥੋੜ੍ਹਾ ਸੰਪਾਦਕ ਕਰਨਾ ਪੈਂਦਾ ਹੈ ਅਤੇ ਸੰਪਾਦਕ ਕਰਨ ਲਈ ਅਸੀਂ ਜ਼ਿਆਦਾਤਰ ਐਡੋਫ ਫੋਟੋਸ਼ੋਪ ਕਰਕੇ ਇੱਕ ਐਡੀਟਿੰਗ ਸੋਫਟਵੇਅਰ ਹੈਗਾ ਵਾ ਜਿਹਦੀ ਆਪਾਂ ਵਰਤੋਂ ਕਰਦੇ ਹਨ ਉਦਾਹਰਣ ਵਜੋਂ ਜੇ ਅਸੀਂ ਇੱਕ ਤਸਵੀਰ ਖਿੱਚਦੇ ਹਾਂ ਸਵੇਰ ਵੇਲੇ ਤਾਂ ਜ਼ਰੂਰੀ ਨਹੀਂ ਹੈ ਕਿ ਉਸ ਤਸਵੀਰ ਵਿੱਚ ਕਾਫੀ ਜ਼ਿਆਦਾ ਰੌਸ਼ਨੀ ਹੋਵੇ ਤਾਂ ਇਸ ਸੋਫਟਵੇਅਰ ਰਾਹੀਂ ਅਸੀਂ ਉਸ ਫੋਟੋ ਵਿੱਚ ਕਾਫੀ ਰੌਸ਼ਨੀ ਪਾ ਸਕਦੇ ਹਾਂ ਉਸਨੂੰ ਹੋਰ ਵਧੀਆ ਤਰੀਕੇ ਨਾਲ ਐਡਿਟ ਕਰ ਸਕਦੇ ਹਾਂ ਤਾਂ ਕਿ ਉਹ ਫੋਟੋ ਕਾਫੀ ਸ਼ਾਨਦਾਰ ਬਣ ਸਕੇ ਹੁਣ ਜਦੋਂ ਆਪਾਂ ਕਦੇ ਵੀ ਕੋਈ ਤਸਵੀਰ ਖਿੱਚਦੇ ਹਨ ਉਸ ਵੇਲੇ ਕਈ ਕਈ ਵਾਰ ਫੋਟੋ ਦੀ ਕੰਪੋਜੀਸ਼ਨ ਥੋੜ੍ਹੀ ਘੱਟ ਰਹਿ ਜਾਂਦੀ ਹੈ ਜਾਂ ਫਿਰ ਉਸਦੀ ਸਾਈਜ਼ ਥੋੜ੍ਹੀ ਜ਼ਿਆਦਾ ਵੱਡੀ ਜਾਂ ਛੋਟੀ ਹੋ ਜਾਂਦੀ ਹੈ ਅਤੇ ਉਹ ਸਭ ਚੀਜ਼ਾਂ ਨੂੰ ਸਹੀ ਕਰਨ ਵਾਸਤੇ ਆਪਾਂ ਇਸ ਸੋਫਟਵੇਅਰ ਦਾ ਯੂਜ਼ ਕਰਦੇ ਹਨ ਅਤੇ ਜਦੋਂ ਵੀ ਆਪਾਂ ਇਸ ਤਰੀਕੇ ਦਾ ਕੋਈ ਸੋਫਟਵੇਅਰ ਯੂਜ਼ ਕਰਦੇ ਹਨ ਉਹ ਉਸ ਫੋਟੋ ਨੂੰ ਹੋਰ ਵਧੀਆ ਤਰੀਕੇ ਨਾਲ ਪ੍ਰਸਤੁਤ ਕਰਦਾ ਹੈ ਇਸ ਕਰਕੇ ਫੋਟੋ ਨੂੰ ਸੰਪਾਦਕ ਸੰਪਾਦਿਤ ਕਰਨਾ ਕਾਫੀ ਵਧੀਆ ਰਹਿੰਦਾ ਹੈ ਉਦਾਹਰਣ ਵਜੋਂ ਅਸੀਂ ਆਹ ਵੀ ਕਹਿ ਸਕਦੇ ਹਨ ਕਿ ਫੋਟੋਗ੍ਰਾਫੀ ਸਿਰਫ ਫੋਟੋ ਖਿੱਚਣ ਦਾ ਕੰਮ ਹੀ ਨਹੀਂ ਕਰਦੀ ਬਲਕਿ ਉਸ ਨੂੰ ਹੋਰ ਸ਼ਾਨਦਾਰ ਵੀ ਬਣਾਉਂਦੀ ਹੈ